ਹੈਲੋ ਸਤਿ ਸ਼੍ਰੀ ਅਕਾਲ ਜੀ ਮੈਮ ਮੈਂ ਬੈਂਕ 'ਚ ਲੱਗੀ ਹੋਈ ਹਾਂ ਅਤੇ ਮੇਰੀ ਦਿੱਲੀ ਤੋਂ ਪੰਜਾਬ ਟਰਾਂਸਫਰ ਹੋਇਆ ਅਤੇ ਮੈਨੂੰ ਮੇਰੀ ਫਰੈਂਡ ਨੇ ਦੱਸਿਆ ਕਿ ਤੁਸੀਂ ਮਤਲਬ ਤੁਹਾਨੂੰ ਕਾਰਾਂ ਬਾਰੇ ਬਹੁਤ ਜਾਣਕਾਰੀ ਆ ਅਤੇ ਮੈਂ ਆਪਣੀ ਅਤੇ ਮੈਂ ਆਪਣੀ ਕਾਰ ਦੀ ਰਜਿਸਟ੍ਰੇਸ਼ਨ ਚੇਂਜ ਕਰਵਾਉਣੀ ਸੀ ਅਤੇ ਉਹਦੇ ਬਾਰੇ ਮਤਲਬ ਕੀ ਲੋੜ ਹੈ ਕੀ ਫੋਰਮ ਵਗੈਰਾ ਚਾਹੀਦੇ ਆਂ ਹਾਂਜੀ ਅਤੇ ਇਹਦੀ ਫੀਸ ਕਿੰਨੀ ਜੇ ਹਾਂਜੀ ਓਕੇ ਅਤੇ ਹਾਂਜੀ ਅਤੇ ਟਾਈਮਿੰਗ ਵਗੈਰਾ ਓਕੇ ਓਕੇ ਅਤੇ ਜੇ ਮਤਲਬ ਬਾਅਦ ਵਿੱਚ ਮਿਲਣਾ ਹੋਵੇ ਤਾਂ ਓਕੇ ਮੈਮ ਥੈਂਕ ਯੂ ਓਕੇ ਹਾਂਜੀ ਥੈਂਕ ਯੂ